ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਔਰਡਰ ਕਰਵਾਉਣਾ ਸੀ ਜੋਮੈਟੋ 'ਚੋਂ ਬੋਲਦੇ ਹੋ ਨਾ ਅਤੇ ਸਾਡੇ ਨਾ ਇੱਕ ਘੰਟੇ ਤੱਕ ਰਿਲੇਟਿਵ ਆ ਰਹੇ ਨੇ ਜੀ ਅਤੇ ਮੈਂ ਸੂਪ ਮੰਗਵਾਉਣਾ ਸੀ ਟੋਮੈਟੋ ਸੂਪ ਅਤੇ ਚਿਕਨ ਸੂਪ ਅਤੇ ਵੈੱਜ ਸੂਪ ਜੀ ਅਤੇ ਘੰਟੇ ਕੁ ਤੱਕ ਚਾਹੀਦਾ ਜੀ ਮੈਨੂੰ ਔਰਡਰ ਅਤੇ ਸਰ ਪ ਕੰਪਲੇਂਟ ਵੀ ਮੇਰੀ ਪਿਛਲੀ ਵਾਰ ਨਾ ਮੈਂ ਮ ਮੰਗਵਾਇਆ ਸੀ ਆਪਣੇ ਔਰਡਰ ਕਰਵਾਇਆ ਸੀ ਅਤੇ ਸ ਉਹ 'ਚ ਨਾ ਪੈਕਿੰਗ ਨਹੀਂ ਵਧੀਆ ਹੋਈ ਸੂਪ ਸੀ ਜਿਹੜਾ ਇਹ ਇੱਕ ਤਾਂ ਠੰਡਾ ਹੋ ਗਿਆ ਜੀ ਅਤੇ ਉੱਪਰੋਂ ਫਿਰ ਉਹ ਨਾ ਪੈਕਿੰਗ ਵੀ ਖਿਲਰ ਗਈ ਸੀ ਮਤਲਬ ਡ ਡੁੱਲ ਗਿਆ ਸੀ ਅਤੇ ਇਸ ਵਾਰ ਪੇ ਪੈਕਿੰਗ ਵਧੀਆ ਕਰਿਓ ਜੀ ਗਰਮ ਰਹਿਣਾ ਚਾਹੀਦਾ ਸੂਪ ਅਤੇ ਮਤਲਬ ਜਿਵੇਂ ਹੁਣ ਤੁਸੀਂ ਭੇਜੋ ਘੰਟੇ ਤੱਕ ਰਿਲੇਟਿਵ ਨੇ ਆਉਣਾ ਘੰਟੇ ਤੱਕ ਹੀ ਗਰਮ ਰਹਿਣਾ ਚਾਹੀਦਾ ਪੈਕਿੰਗ ਵਧੀਆ ਕਰੋ ਪੈਕਿੰਗ ਦੇ ਐਕਸਟਰਾ ਚਾਰਜਿਸ ਚਾਹੀਦੇ ਤੁਹਾਨੂੰ ਉਹ ਵੀ ਮੈਂ ਦੇਣ ਨੂੰ ਤਿਆਰ ਹੈ ਬਸ ਮੈਨੂੰ ਪੈਕਿੰਗ ਵਧੀਆ ਚਾਹੀਦੀ ਹੈ ਅਤੇ ਉਦੋਂ ਤੱਕ ਗਰਮ ਚਾਹੀਦਾ ਮੈਨੂੰ ਜਿੰਨੇ ਤੋਂ ਜ਼ਿਆਦਾ ਦੇਰ ਹੋ ਸਕੇ ਉਨਾਂ ਚਿਰ ਗਰਮ ਰਹੇ ਜੀ ਅਤੇ ਬਾਕੀ ਕੁਆਲਿਟੀ ਵਧੀਆ ਭੇਜਿਓ ਜੀ ਚਲੋ ਠੀਕ ਹੈ ਸਰ ਥੈਂਕ ਯੂ ਜੀ